ਹਾਂਜੀ ਮੈਂ ਤੁਹਾਡੇ ਕੋਲੋਂ ਬੱਚਿਆਂ ਦੇ ਸਾਹਿਤ ਨਾਲ਼ ਸੰਬੰਧਿਤ ਕੁਝ ਪੁਸਤਕਾਂ ਮੰਗਵਾਈਆਂ ਸੀ ਬਹੁਤ ਅੱਛਾ ਲੱਗਿਆ ਬਹੁਤ ਸਾਰੀਆਂ ਪੁਸਤਕਾਂ ਬੜੇ ਮਨ ਨੂੰ ਲੁਭਾਵਣੀਆਂ ਹੈ ਔਰ ਬੱਚਿਆਂ ਦੇ ਪੱਧਰ ਦੀਆਂ ਹੈਗੀਆਂ ਤੁਹਾਡਾ ਜਿਹੜਾ ਪੇਪਰ ਹੈ ਉਹ ਬਹੁਤ ਅੱਛਾ ਲੱਗਿਆ ਹੋਇਆ ਛਪਾਈ ਵੀ ਬਹੁਤ ਹੈ ਬਹੁਤ ਸਾਰੇ ਜਿਹੜੇ ਉਹ ਹੁੰਦੇ ਹੈ ਕੀ ਉਹਨੂੰ ਆਪਾਂ ਕਹਿੰਦੇ ਹਾਂ ਪਬਲਿਸ਼ਰ ਬਹੁਤ ਸਾਰੇ ਪਬਲਿਸ਼ਰ ਜਿਹੜੇ ਹੈ ਉਹ ਗਲਤੀਆਂ ਛੱਡ ਜਾਂਦੇ ਬਹੁਤ ਸਾਰੀਆਂ ਪਰ ਤੁਹਾਡੀਆਂ ਕਿਤਾਬਾਂ ਪੜ੍ਹ ਕੇ ਮੈਨੂੰ ਇਹੋ ਜਿਹਾ ਲੱਗਿਆ ਕਿ ਕੋਈ ਵੀ ਗਲਤੀ ਨਹੀਂ ਹੈ ਔਰ ਬੱਚਿਆਂ ਦੇ ਬੌਧਿਕ ਨੈਤਿਕ ਵਿਕਾਸ ਲਈ ਇਹ ਪੁਸਤਕਾਂ ਬੜੀਆਂ ਲਾਹੇਵੰਦ ਹੋਣਗੀਆਂ ਕੀਮਤ ਵੀ ਬੜੀ ਵਾਜਬ ਹੈ ਔਰ ਪੁਸਤਕਾਂ ਦੀ ਦਿੱਖ ਵੀ ਬਹੁਤ ਸੋਹਣੀ ਜਿੱਥੇ ਮੈਂ ਆਪ ਪੜ੍ਹੀਆਂ ਉੱਥੇ ਆਪਣੇ ਬੱਚਿਆਂ ਨੂੰ ਪੜ੍ਹਾਈਆਂ ਅਤੇ ਸਾਰੇ ਬੱਚੇ ਇਹਨਾਂ ਕਿਤਾਬਾਂ ਨੂੰ ਪੜ੍ਹ ਕੇ ਬਹੁਤ ਖੁਸ਼ ਹੋਏ ਹੈ ਬੜਾ ਗਿਆਨ ਮਿਲਿਆ ਬਹੁਤ ਬਹੁਤ ਧੰਨਵਾਦ